ਡੇਂਗੂ ਅਤੇ ਮਲੇਰੀਆ ਇਹ ਬਹੁਤ ਹੀ ਭਿਆਨਕ ਬਿਮਾਰੀਆਂ ਨੇ ਇਹਨਾਂ ਤੋਂ ਬਚਣ ਲਈ ਸਾਨੂੰ ਸਖ਼ਤ ਲੋੜ ਹੈ ਇਹ ਬਿਮਾਰੀ ਜਿਵੇਂ ਕਿ ਬਾਰਿਸ਼ ਦਾ ਮੌਸਮ ਹੈ ਉਸ ਵਿੱਚ ਜ਼ਿਆਦਾ ਫੈਲਣ ਦਾ ਡਰ ਰਹਿੰਦਾ ਹੈ ਜੋ ਕਿ ਘਰਾਂ ਵਿੱਚ ਕਿਤੇ ਪਾਣੀ ਖੜ੍ਹ ਗਿਆ ਉਸ 'ਤੇ ਮੱਛਰ ਪੈਦਾ ਹੋ ਜਾਂਦਾ ਹੈ ਕੂਲਰਾਂ ਵਿੱਚ ਆਪਾਂ ਪਾਣੀ ਭਰਦੇ ਹਾਂ ਜੇ ਉਸਦੀ ਚੰਗੀ ਤਰ੍ਹਾਂ ਦੇਖ ਰੇਖ ਨਾ ਕੀਤੀ ਜਾਵੇ ਤਾਂ ਉਹਨੂੰ ਜ਼ਿਆਦਾ ਟਾਇਮ ਹੋ ਜਾਵੇ ਪਾਣੀ ਨੂੰ ਤਾਂ ਉਹਦੇ ਵਿੱਚ ਮੱਛਰ ਪੈਦਾ ਹੋ ਜਾਂਦੇ ਆ ਉਸ ਮੱਛਰ ਤੋਂ ਸਾਨੂੰ ਡੇਂਗੂ ਮਲੇਰੀਆ ਹੋ ਜਾਂਦਾ ਹੈ ਡੇਂਗੂ ਮਲੇਰੀਆ ਤੋਂ ਬਚਣ ਲਈ ਸਾਨੂੰ ਸਾਫ਼ ਸਫਾਈ ਬਹੁਤ ਹੀ ਅਤਿ ਜ਼ਰੂਰੀ ਹੈ ਸਾਡੇ ਘਰਾਂ ਦੇ ਵਿੱਚ ਡੇਲੀ ਸਫਾਈ ਸਾਡੇ ਵਾੜਾਂ ਦੇ ਵਿੱਚ ਜੋ ਵੀ ਕੋਈ ਨਾਲੀ ਹੈ ਕੋਈ ਸਾਈਡ 'ਤੇ ਟੋਭਾ ਟੋਆ ਉਹਦੇ ਵਿੱਚ ਪਾਣੀ ਨਾ ਖੜਨ ਦਿੱਤਾ ਜਾਵੇ ਜੋ ਵੀ ਕੋਈ ਸਾਡੇ ਘਰਾਂ ਦੇ ਬਾਹਰ ਨਾਲੀਆਂ ਨੇ ਉਹਨਾਂ 'ਤੇ ਘਾਹ ਹੋ ਜਾਂਦਾ ਹੈ ਘਾਹ 'ਤੇ ਮੱਛਰ ਪੈਦਾ ਹੋ ਜਾਂਦਾ ਹੈ ਇਸ ਕਰਕੇ ਸਾਨੂੰ ਇਹ ਬਿਮਾਰੀਆਂ ਲੱਗਦੀਆਂ ਨੇ ਡੇਂਗੂ ਅਤੇ ਮਲੇਰੀਏ ਤੋਂ ਬਚਣ ਲਈ ਸਭ ਤੋਂ ਵੱਧ ਜ਼ਰੂਰੀ ਹੈ ਵੀ ਘਰ ਦੀ ਸਾਫ਼ ਸਫਾਈ ਸਾਰੇ ਘਰ ਪੋਚਾ ਲਗਾਉਣਾ ਬਹੁਤ ਹੀ ਜ਼ਰੂਰੀ ਹੈ ਮਲੇਰੀਆ ਇੱਕ ਇਹੋ ਜਿਹੀ ਚੀਜ਼ ਹੈ ਜੋ ਕਿ ਬਹੁਤ ਹੀ ਭਿਆਨਕ ਰੋਗ ਬਣ ਜਾਂਦਾ ਹੈ ਅਤੇ ਸਾਨੂੰ ਘਰਾਂ ਵਿੱਚ ਫਰਨੈਲ ਦੇ ਪੋਚੇ ਲਗਾਉਣੇ ਚਾਹੀਦੇ ਹਨ ਡੇਲੀ ਝਾੜੂ ਕੱਢਣਾ ਚਾਹੀਦਾ ਹੈ ਜੋ ਵੀ ਕੋਈ ਪਾਣੀ ਖੜ੍ਹਾ ਹੈ ਉਸ ਨੂੰ ਸਾਫ਼ ਕਰਨਾ ਚਾਹੀਦਾ ਹੈ ਅਤੇ ਸਫਾਈ ਵੱਲ ਖ਼ਾਸ ਧਿਆਨ ਦੇਣਾ ਚਾਹੀਦਾ ਹੈ ਜੋ ਕਿ ਆਪਾਂ ਇਸ ਭਿਆਨਕ ਬਿਮਾਰੀ ਤੋਂ ਬਚ ਸਕੀਏ ਡੇਂਗੂ ਅਤੇ ਮਲੇਰੀਆ ਬਹੁਤ ਹੀ ਭਿਆਨਕ ਬਿਮਾਰੀ ਹੈ ਜੋ ਅੱਜ ਕੱਲ੍ਹ ਬਾਰਿਸ਼ ਦੇ ਮੌਸਮ ਵਿੱਚ ਜ਼ਿਆਦਾ ਹੁੰਦਾ ਹੈ ਅਤੇ ਸਾਨੂੰ ਵੱਧ ਤੋਂ ਵੱਧ ਸਫਾਈ ਸੇਵਕ ਸ ਦੀ ਲੋੜ ਹੈ ਅਤੇ ਜੋ ਕਿ ਸਰਕਾਰ ਸਮੇਂ ਸਮੇਂ 'ਤੇ ਆਪਣੀ ਦਵਾਈ ਵੀ ਛਿੜਕਦੀ ਹੈ ਪਰ ਇਸ ਨਾਲ ਆਪਾਂ ਨੂੰ ਆਪਣਾ ਆਪਣੇ ਘਰ ਦਾ ਵੀ ਧਿਆਨ ਰੱਖਣਾ ਪੈਣਾ ਹੈ ਇਕੱਲੀਆਂ ਸਰਕਾਰਾਂ 'ਤੇ ਨਹੀਂ ਆਪਾਂ ਨੂੰ ਆਪਣੇ ਆਪਣੇ ਘਰ ਦਾ ਧਿਆਨ ਰੱਖਣਾ ਹੈ ਜੋ ਕਿ ਸਾਫ਼ ਸਫਾਈ ਰੱਖੀ ਤਾਂ ਇਸ ਤੋਂ ਬਚਾਅ ਕੀਤਾ ਜਾ ਸਕਦਾ ਹੈ ਧੰਨਵਾਦ